ਸਤਿ ਸ਼੍ਰੀ ਅਕਾਲ ਜੀ ਵੀਰੇ ਮੈਂ ਕਿਰਨਜੋਤ ਗੱਲ ਕਰ ਰਹੀ ਹਾਂ ਮੈਂ ਕੁਝ ਸਮਾਂ ਪਹਿਲਾਂ ਤੁਹਾਡੀ ਕੈਬ ਦੇ ਵਿੱਚੋਂ ਉਤਰੀ ਸੀ ਤੁਸੀਂ ਮੈਨੂੰ ਹਜੇ ਵਾਲਾ ਕਾਰਖਾਨਾ ਬੁਢਲਾਡਾ ਵਿਖੇ ਉਤਾਰਿਆ ਸੀ ਇਹ ਕੈਬ ਮੈਂ ਬਠਿੰਡੇ ਤੋਂ ਬੁਢਲਾਡੇ ਆਉਣ ਲਈ ਕੀਤੀ ਸੀ ਮੈਂ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਸੀ ਜੇ ਤੁਹਾਨੂੰ ਯਾਦ ਹੋਵੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਇੱਕ ਬੈਗ ਤੁਹਾਡੇ ਕੈਬ ਦੇ ਵਿੱਚ ਰਹਿ ਗਿਆ ਹੈ ਇਸ ਬਟੂਏ ਦਾ ਇਹ ਜਿਹੜਾ ਮੇਰਾ ਬੈਗ ਸੀਗਾ ਇਹਦੇ ਬਟੂਏ ਦੀ ਸ਼ੇਪ ਦਾ ਹੈ ਇਹ ਭੂਰੇ ਰੰਗ ਦਾ ਹੈ ਇਹਦੇ 'ਤੇ ਉੱਪਰ ਇੱਕ ਮੈਂਟੈਲਿਕ ਲੋਗੋ ਵੀ ਬਣਿਆ ਹੋਇਆ ਅਤੇ ਇਹਦੇ ਵਿੱਚ ਮੇਰੇ ਕੁਝ ਜ਼ਰੂਰੀ ਦਸਤਾਵੇਜ਼ ਨੇ ਕੁਝ ਕੁਝ ਪੈਸੇ ਵੀ ਹਨ ਮੈਂ ਕਿਰਪਾ ਕਰਕੇ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਜੇਕਰ ਤੁਹਾਨੂੰ ਕੋਈ ਮਿਲਦਾ ਹੈ ਜਾਂ ਤੁਸੀਂ ਇਹ ਮੇਰੇ ਬੈਗ ਨੂੰ ਦੇਖਿਆ ਹੋਵੇ ਤਾਂ ਮੈਨੂੰ ਪਲੀਜ਼ ਦੱਸਣ ਦੀ ਕਿਰਪਾਲਤਾ ਕਰੋ ਮੈਂ ਤੁਹਾਨੂੰ ਲੋੜੀਂਦਾ ਬਣਦਾ ਇਨਾਮ ਵੀ ਜ਼ਰੂਰ ਦੇਵਾਂਗੀ ਇਹ ਇਹਦੇ ਵਿੱਚ ਪੈਸਿਆਂ ਤੋਂ ਇਲਾਵਾ ਇਲਾਵਾ ਮੇਰੇ ਜ਼ਰੂਰੀ ਡਾਕੂਮੈਂਟ ਵੀ ਨੇ ਜਿਹੜੇ ਕਿ ਮੈਨੂੰ ਚਾਹੀਦੇ ਹਨ ਤਾਂ ਕਿਰਪਾ ਕਰਕੇ ਪਲੀਜ਼ ਜੇ ਬਟੂਆ ਤੁਹਾਡੀ ਕੈਬ ਦੇ ਵਿੱਚ ਰਹਿ ਗਿਆ ਹੈ ਤਾਂ ਮੈਨੂੰ ਦੇਣ ਦੀ ਕਿਰਪਾਲਤਾ ਕਰੋ ਧੰਨਵਾਦ